ਹੈਲੋ ਵਧੀਆ ਜੀ ਵਧੀਆ ਹਾਂਜੀ

ਨਵਾਂਸ਼ਹਿਰ ਚੌਂਕ 'ਤੇ ਹੀ ਆ ਸਬਜ਼ੀ ਵਾਲੀ ਦੁਕਾਨ ਤਾਂ ਮੁਹੰਮਦ ਅਲੀ ਖਾਨ ਦੇ ਨਾਲ ਏ ਆ ਉਹਦੀ ਦੁਕਾਨ ਸਬਜ਼ੀ ਤਾਂ ਵਧੀਆ ਐਂ ਹੁੰਦੀ ਹੈ ਨਾ ਉਹਨਾਂ ਦੇ ਆਪਣੇ ਖੇਤ ਹੈ ਉਹ ਉਹ ਕਿਹੜੇ ਮੰਡੀ ਲੈ ਕੇ ਆਉਂਦੇ ਖਰੀਦ ਕੇ ਫਰੈਸ਼ ਫਰੈ ਉਹਨਾਂ ਦੇ ਆਪਣੇ ਖੇਤ ਹੈ ਉਹ ਆਪਣੀ ਬੀਜਦੇ ਹੈ ਉਹ ਸਬਜ਼ੀਆਂ ਇਹ ਤਾਂ ਉਹਨਾਂ ਕੋਲ ਰੇਟ ਵਧੀਆ ਸਭ ਵਧੀਆ ਮੈਂ ਕੋਈ ਨਾ ਮੈਂ ਗੱਲ ਕਰਾ ਦੁੰਗਾ ਹਾਂਜੀ ਅਸੀਂ ਸ਼ੁਰੂ ਤੋਂ ਉਹਨਾਂ ਕੋਲ ਹਾਂ ਬਸ ਉਹਨਾਂ ਕੋਲ ਲੈਂਦੇ ਹੈ ਕਦੇ ਬਾਈ ਚਾਂਸ ਕਦੇ ਮੀਂਹ ਕਣੀ 'ਚ ਨਾ ਜਾ ਹੋਵੇ ਕਿਸੇ ਪਾਸੇ ਤਾਂ ਸਬਜ਼ੀ ਸੁਬਜ਼ੀ ਵਾਲੇ ਆਉਂਦੇ ਸਾਡੀ ਗਲੀ 'ਚ ਅਸੀਂ ਉਹਨਾਂ ਕੋਲ ਲੈ ਲਈ ਦੀ ਹੈ ਫਿਰ ਜ਼ਿਆਦਾਤਰ ਹੁੰਦੇ ਹੈ ਨਵਾਂਸ਼ਹਿਰ ਚੌਂਕ 'ਤੇ ਉਨ੍ਹਾਂ ਕੋਲ ਤੋਂ ਹਾਂਜੀ ਵਧੀਆ ਹੁੰਦੀਆਂ ਤੁਸੀਂ ਇਕ ਵਾਰ ਟਰਾਈ ਕਰਕੇ ਦੇਖਿਓ ਠੀਕ ਹੈ ਜੀ ਹਾਂਜੀ ਖੋਲ ਲੈਂਦੇ ਹੈ ਬਾ ਜ਼ਿਆਦਾਤਰ ਨਾ ਸਬਜ਼ੀਆਂ ਖਰਾਬ ਨਹੀਂ ਹੁੰਦੀਆਂ ਵੈਸੇ ਮਾੜੀ ਮੋਟੀ ਕਈ ਕਈ ਵਾਰ ਮਿਸਟੇਕ ਹੋ ਜੂ ਉਹ ਵਾਪਸ ਕਰ ਲੈਂਦੇ ਹੈ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਬੰਦੇ ਵਧੀਆ ਬੰਦੇ ਆ ਜੀ ਨਵਾਂਸ਼ਹਿਰ ਚੌਂਕ 'ਚ ਆ ਜਿਓ ਮੈਂ ਤੁਹਾਡੇ ਗੱਲ ਬਾਤ ਕਰਾ ਦੂਗਾ ਨਾਲੇ ਬਾਕੀ ਤੁਸੀਂ ਇਕ ਵਾਰੀ ਦੇਖ ਲਿਓ ਬਾਕੀ ਨਾਲ ਰੇਟ ਵਧੀਆ ਸਬਜ਼ੀ ਦਵਾਦੂ ਕੋਈ ਨਾ ਤੁਸੀਂ ਆ ਜਿਓ ਸ਼ਾਮ ਨੂੰ ਮੈਨੂੰ ਫੋਨ ਕਰ ਲਿਓ ਉੱਥੇ ਆ ਕੇ ਚੌਂਕ ਫਿਰ ਮੈਂ ਆ ਜੂਗਾ ਨਾਲੇ